ਹੈਲੋ ਹਾਂਜੀ ਪ੍ਰੀਤੀ ਕੀ ਹਾਲ ਆ ਹਾਂਜੀ ਹਾਂਜੀ ਮੈਂ ਵਧੀਆ ਹੋਰ ਕੀ ਕਰ ਰਹੇ ਹੋ ਇਹਦਾ ਵੀ ਵਧੀਆ ਖੇਡੀ ਜਾਂਦੀ ਆ ਹਾਂਜੀ ਤੁਸੀਂ ਦੱਸੋ ਕੀ ਹਾਲ ਆ ਹਾਂਜੀ ਉਹ ਤਾਂ ਹੈ ਮੈਂ ਵੀ ਸੋਚਦੀ ਸੀ ਵੀ ਆਪਣੀ ਬੇਟੀ ਨੂੰ ਕਿੱਥੇ ਲਗਾਵਾਂ ਉਹਦੀ ਉਹਨੂੰ ਵੀ ਸਕੂਲ ਲਗਾਉਣਾ ਅਤੇ ਹਾਂਜੀ ਹਾਂਜੀ ਉਹ ਤਿੰਨ ਸਾਢੇ ਤਿੰਨ ਸਾਲ ਦੀ ਹੋ ਗਈ ਉਹ ਹਾਂਜੀ ਸੋਚ ਹੀ ਰਹੀ ਸੀ ਵੀ ਕਿੱਥੇ ਲਗਾਈਏ ਵੀ ਮੈਂ ਸੋਚਿਆ ਵੀ ਫਿਰ ਚਲੋ ਪ੍ਰੀਤੀ ਨੂੰ ਫੋਨ ਕਰ ਲਈਏ ਉਹ ਮੈਨੂੰ ਦੱਸੂ ਵੀ ਕਿੱਦਾਂ ਵੀ ਜਿਹੜੇ ਸਕੂਲ ਵਧੀਆ ਹਾਂਜੀ ਹਾਂਜੀ ਹਾਂਜੀ ਓਕੇ ਸਟੱਡੀ ਉੱਥੇ ਕਿੱਦਾਂ ਦੀ ਆ ਹਾਂਜੀ ਉਹ ਤਾਂ ਹੈ ਪਰ ਬੱਚੇ ਹਜੇ ਛੋਟੇ ਹੈ ਨਾ ਬੱਚਿਆਂ ਨੂੰ ਇੰਨੀ ਸਮਝ ਨਹੀਂ ਹੈਗੀ ਹਾਂਜੀ

ਬਹੁਤ ਵਧੀਆ ਓਕੇ ਹੁਣ ਕਿਹੜੀ ਕਲਾਸ 'ਚ ਪੜ੍ਹਦਾ ਅੱਛਾ ਠੀਕ ਹੈ ਮੈਂ ਤਾਂ ਉਹ ਸੋਚਦੀ ਸੀ ਕੇਂਦਰੀ ਵਿਦਿਆਲੇ ਵੀ ਉਹ ਪਤਾ ਨਹੀਂ ਕਿੱਦਾਂ ਦਾ ਹਾਂਜੀ ਹਾਂਜੀ ਹਜੇ ਤਾਂ ਇਹ ਛੋਟੀ ਆ ਹਾਂਜੀ ਇਹ ਤਾਂ ਨੇੜੇ ਆ ਮੈਨੂੰ ਇਹ ਸੀ ਨਾ ਜੀ ਇੱਕ ਵਾਰ ਪੁੱਛ ਕੇ ਵੀ ਕਿੱਦਾਂ ਦਾ ਮਾਹੌਲ ਬੱਚਿਆਂ ਦਾ ਫਿਰ ਟੈਂਸ਼ਨ ਹੁੰਦੀ ਰਹਿੰਦੀ ਵੀ ਅੱਜ ਕੱਲ੍ਹ ਮਾਹੌਲ ਵੀ ਠੀਕ ਨਹੀਂ ਹੈਗਾ ਨਾ ਸਕੂਲਾਂ 'ਚ ਹਾਂਜੀ ਹਾਂਜੀ ਉਹ ਤਾਂ ਹੈ ਅੱਛਾ

ਮੈਂ ਹੁਣ ਵੇਖ ਰਿਹਾ ਵੀ ਸਕੂਲਸ 'ਚ ਕਈ ਵਾਰ ਸੁਣਨ ਨੂੰ ਮਿਲਦਾ ਸਕੂਲਸ ਦੇ ਵਿੱਚ ਵੀ ਬੱਚਿਆਂ ਦੇ ਛੋਟੇ ਜਿਹੜੇ ਬੱਚੇ ਉਹਨਾਂ ਦੀ ਤਾਂ ਬਹੁਤ ਜ਼ਿਆਦਾ ਦੇਖ ਰੇਖ ਕਰਨੀ ਪੈਂਦੀ ਆ ਨਾ ਤਾਂ ਕਰਕੇ ਵੀ ਇੰਨਾ ਕੇਅਰ ਕੁਅਰ ਹੈ ਨੀਗੀ ਵੀ ਬੱਚਾ ਮੇਰਾ ਛੋਟਾ ਹਜੇ ਹਾਂਜੀ ਹਾਂ ਓਪਨ ਹੋ ਜਾਂਦੀਆਂ ਹਾਂ ਉਹਨਾਂ ਨੇ ਤਾਂ ਖਿਡਾਉਣਾ ਹੀ ਆ ਫਿਰ ਵੀ ਅਸੀਂ ਵੀ ਛੋਟਾ ਵੀ ਸੋਚ ਥੋੜ੍ਹਾ ਦੇਖ ਦੇਖ ਵੀ ਬੱਚਾ ਦੱਸ ਨਹੀਂ ਸਕਦਾ ਹਜੇ ਪੋਟੀ ਸ਼ੁਸ਼ੁ ਹਾਂਜੀ ਹਾਂਜੀ ਹਾਂਜੀ ਠੀਕ ਹੈ ਫਿਰ ਮੈਂ ਤੈਨੂੰ ਫੋਨ ਕਰ ਦੂੰਗੀ ਆਪਾਂ ਦੋਵੇਂ ਇਕੱਠੇ ਚਲ ਪਾਂਗੇ ਵੇਖ ਆਵਾਂਗੇ ਇੱਕ ਵਾਰ ਉਹਨਾਂ ਨਾਲ ਗੱਲਬਾਤ ਕਰ ਆਵਾਂ ਵੀ ਕਿੱਦਾਂ ਕੀ ਆ ਹਾਂਜੀ ਠੀਕ ਹੈ ਜੀ ਹਾਂਜੀ ਧੰਨਵਾਦ ਜੀ